ਹਾਂਜੀ ਇੱਕ ਲੂਪ ਦੇ ਟਾਂਕਿਆਂ ਦੇ ਨਾਲ ਕਢਾਈ ਹੁੰਦੀ ਆ ਉਹ ਕਢਾਈ ਮੇਰੇ ਲਈ ਸਭ ਤੋਂ ਚੁਣੌਤੀਪੂਰਨ ਸੀਗੀ ਜਦੋਂ ਮੈਂ ਫੈਸ਼ਨ ਡਿਜ਼ਾਇਨਿੰਗ ਦਾ ਡਿਪਲੋਮਾ ਕਰਦੀ ਸੀਗੀ ਉਸ ਦੇ ਵਿੱਚ ਉਹ ਕਢਾਈ ਮੇਰੇ ਲਈ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਸੀਗੀ ਔਰ ਮੇਰੇ ਲਈ ਸਭ ਤੋਂ ਔਖਾ ਪਹਿਰਾਵਾ ਜਿਹੜਾ ਉਹ ਇਹ ਹੀ ਰਿਹਾ ਕਿ ਮੈਂ ਲਹਿੰਗਾ ਚੋਲੀ ਖੁਦ ਤਿਆਰ ਕੀਤਾ ਸੀਗਾ ਔਰ ਉਸ ਲਹਿੰਗਾ ਚੋਲੀ ਨੂੰ ਤਿਆਰ ਕਰਨ ਦੇ ਵਿੱਚ ਮੈਨੂੰ ਘੱਟੋ ਘੱਟ ਦੋ ਤੋਂ ਤਿੰਨ ਹਫ਼ਤੇ ਲੱਗ ਗਏ ਸਨ ਔਰ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਸੀਗੀ ਉਸਦੀ ਜਿਹੜੀ ਚੋਲੀ ਸੀਗੀ ਲਹਿੰਗੇ ਦੇ ਨਾਲ ਦੀ ਉਹਦੇ ਬਾਜੂਆਂ ਦੇ ਵਿੱਚ ਮੈਂ ਕੱਟ ਪਾਇਆ ਹੋਇਆ ਸੀਗਾ ਜਿਹਨੂੰ ਸਿਲਾ ਸਿਉਣ ਦੇ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਉਹ ਔਖ ਹੋਈ ਸੀਗੀ ਮੇਰੇ ਲਈ ਉਹ ਡਰੈੱਸ ਨੂੰ ਤਿਆਰ ਕਰਨਾ ਉਸ ਲਹਿੰਗੇ ਨੂੰ ਤਿਆਰ ਕਰਨਾ ਬਹੁਤ ਹੀ ਔਖਾ ਸੀਗਾ ਉਸਨੂੰ ਸਿਉਣ ਦੇ ਵਿੱਚ ਔਰ ਡਿਜ਼ਾਇਨ ਕਰਨ ਦੇ ਵਿੱਚ ਮੈਨੂੰ ਕਾਫ਼ੀ ਸਮਾਂ ਲੱਗ ਗਿਆ ਸੀਗਾ ਔਰ ਬਹੁਤ ਹੀ ਜ਼ਿਆਦਾ ਮੈਨੂੰ ਮਿਹਨਤ ਕਰਨੀ ਪਈ ਸੀਗੀ ਮੈਨੂੰ ਹਜੇ ਵੀ ਯਾਦ ਆ ਕਿ ਮੈਂ ਰਾਤ ਰਾਤ ਭਰ ਜਾਗ ਜਾਗ ਕੇ ਉਸ ਲਹਿੰਗੇ ਚੋਲੀ ਨੂੰ ਤਿਆਰ ਕੀਤਾ ਸੀਗਾ ਔਰ ਮੈਂ ਆਪਣੇ ਫੈਸ਼ਨ ਡਿਜ਼ਾਇਨਿੰਗ ਦੇ ਡਿਪਲੋਮੇ ਦੇ ਵਿੱਚ ਉਸਨੂੰ ਜਮ੍ਹਾਂ ਕਰਵਾਇਆ ਸੀਗਾ ਆਪਣਾ ਤਿਆਰ ਕਰਕੇ ਮਿਹਨਤ ਕਰਕੇ ਔਰ ਮੈਂ ਆਪਣੇ ਹੱਥਾਂ ਦੇ ਨਾਲ ਹੀ ਉਸ ਚੋਲੀ ਨੂੰ ਲਟਕਣ ਵੀ ਲਗਾ ਲਗਾਏ ਸਨ ਜਿਹੜੇ ਕਿ ਬੜੀ ਮਿਹਨਤ ਦੇ ਨਾਲ ਬਣੇ ਸਨ ਸੋ ਮੇਰੇ ਲਈ ਹੁਣ ਤੱਕ ਦਾ ਸਭ ਤੋਂ ਔਖਾ ਪਹਿਰਾਵਾ ਇਹ ਹੀ ਰਿਹਾ ਆ ਲਹਿੰਗਾ ਚੋਲੀ ਜਿਹੜਾ ਮੈਂ ਕਿ ਦੋ ਤਿੰਨ ਹਫ਼ਤਿਆਂ ਦੇ ਵਿੱਚ ਤਿਆਰ ਕੀਤਾ ਸੀਗਾ ਔਰ ਮੈਨੂੰ ਬਹੁਤ ਜ਼ਿਆਦਾ ਮਿਹਨਤ ਲੱਗੀ ਸੀਗੀ ਉਸ ਨੂੰ ਤਿਆਰ ਕਰਨ ਦੇ ਵਿੱਚ